ਭਾਰਤ ਦੇ ਵਿੱਚ ਬਹੁਤ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਜਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਥੇ ਸਾਨੂੰ ਬਹੁਤ ਹੀ ਜ਼ਿਆਦਾ ਮਨੋਰੰਜਨ ਵਾਲੀਆਂ ਚੀਜ਼ਾਂ 'ਤੇ ਬਹੁਤ ਹੀ ਜਾਣਕਾਰੀ ਵੀ ਮਿਲ ਸਕਦੀ ਹੈਗੀ ਹੈ ਇਹੋ ਜਿਹੀਆਂ ਕਈ ਥਾਵਾਂ ਨੇ ਜਿੱਥੇ ਬਹੁਤ ਜ਼ਿਆਦਾ ਜਾਣਕਾਰੀ ਮਿਲ ਸਕਦੀ ਹੈਗੀ ਆ ਅਤੇ ਬਹੁਤ ਹੀ ਜ਼ਿਆਦਾ ਇੱਥੇ ਧਾਰਮਿਕ ਥਾਵਾਂ ਵੀ ਹੈਗੀਆਂ ਨੇ ਜਿੱਥੇ ਜਾ ਕੇ ਸਾਨੂੰ ਕਿਸੇ ਵੀ ਧਰਮ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈਗੀ ਆ ਜਿਵੇਂ ਅਨੰਦਪੁਰ ਸਾਹਿਬ ਜੇ ਜਾਂਦੇ ਹਾਂ ਤਾਂ ਉੱਥੇ ਬਹੁਤ ਵੱਡਾ ਗੁਰਦੁਆਰਾ ਹੈ ਅਤੇ ਗੁਰਦੁਆਰੇ ਦੇ ਨਾਲ ਉੱਥੇ ਬਹੁਤ ਵੱਡਾ ਮਿਊਜ਼ੀਅਮ ਹੈ ਜਿਹਨੂੰ ਵਿਰਾਸਤ ਏ ਖਾਲਸਾ ਕਿਹਾ ਜਾਂਦਾ ਹੈ ਅਤੇ ਇੱਥੇ ਸਿੱਖ ਇਤਿਹਾਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ ਅਤੇ ਪੰਜਾਬ ਦੇ ਕਲਚਰ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ ਇੱਥੇ ਪੰਜਾਬ ਦੇ ਕਲਚਰ ਨੂੰ ਬਹੁਤ ਵਧੀਆ ਢੰਗ ਨਾਲ ਦਰਸਾਇਆ ਗਿਆ ਹੈ ਅਤੇ ਇੱਥੇ ਪੰਜਾਬ ਦੇ ਕਲਚਰ ਬਾਰੇ ਬਹੁਤ ਡੂੰਘੀ ਜਾਣਕਾਰੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਅਤੇ ਹੋਰ ਵੀ ਕਈ ਥਾਵਾਂ ਨੇ ਜਿੱਥੇ ਲੋਕ ਮਨੋਰੰਜਨ ਲਈ ਜਾ ਸਕਦੇ ਹਨ ਜਿਵੇਂ ਰਾਜਸਥਾਨ ਉੱਥੇ ਬਹੁਤ ਸਾਰੇ ਪੁਰਾਣੇ ਕਿਲ੍ਹੇ ਹਨ ਪੁਰਾਣੇ ਮਹਾਰਾਜਿਆਂ ਦੇ ਜਿੱਥੇ ਬਹੁਤ ਵਧੀਆ ਰਮਣੀਕ ਥਾਵਾਂ ਨੇ ਘੁੰਮਣ ਵਾਸਤੇ ਅਤੇ ਹੋਰ ਵੀ ਕਈ ਜਗ੍ਹਾਵਾਂ ਨੇ ਜਿਵੇਂ ਸ਼ਿਮਲਾ ਇੱਥੇ ਲੋਕ ਸਰਦੀਆਂ ਦੇ ਵਿੱਚ ਜਾਂਦੇ ਹਨ ਜਿੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਅਤੇ ਇਹ ਸਿਰਫ਼ ਕੁਝ ਗਿਣੀਆਂ ਚੁਣੀਆਂ ਮਸ਼ਹੂਰ ਥਾਵਾਂ ਨੇ ਇਹ ਤੋਂ ਇਲਾਵਾ ਬਹੁਤ ਹੋਰ ਵੀ ਥਾਵਾਂ ਹਨ ਜਿੱਥੇ ਲੋਕ ਜਾ ਕੇ ਬਹੁਤ ਸਾਰੀ ਜਾਣਕਾਰੀ ਅਤੇ ਮਨੋਰੰਜਨ ਹਾਸਿਲ ਕਰ ਸਕਦੇ ਹਨ ਅਤੇ ਲੋਕਾਂ ਨੂੰ ਜਿੱਥੇ ਜ਼ਰੂਰ ਜਾਣਾ ਚਾਹੀਦਾ ਹੈ